ਭਾਰਤ ਦੇ ਵਿੱਚ ਗੁਰੂ ਚੇਲਾ ਪਰੰਪਰਾ ਇੱਕ ਬਹੁਤ ਪੁਰਾਣੀ ਪਰੰਪਰਾ ਹੈ ਅਤੇ ਇਸ ਪਰੰਪਰਾ ਦੇ ਅਨੁਸਾਰ ਗੁਰੂ ਅਤੇ ਚੇਲੇ ਆਹਮੋ ਸਾਹਮਣੇ ਬੈਠਦੇ ਹਨ ਅਤੇ ਜੋ ਗੁਰੂ ਹੈ ਉਹ ਸਾਹਮਣੇ ਬਿਠਾ ਕੇ ਚੇਲਿਆਂ ਨੂੰ ਵਿੱਦਿਆ ਦਿੰਦੇ ਹਨ ਅਤੇ ਇਹ ਇੱਕ ਬਹੁਤ ਹੀ ਪ੍ਰਭਾਵੀ ਪਰੰਪਰਾ ਹੈ ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ ਖਾਸ ਤੌਰ 'ਤੇ ਜੇ ਮੈਂ ਸੰਗੀਤ ਵਿੱਦਿਆ ਦੀ ਗੱਲ ਕਰਾਂ ਤਾਂ ਸੰਗੀਤ ਵਿੱਦਿਆ ਦੇ ਵਿੱਚ ਇਹ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਸੰਗੀਤ ਜਾਂ ਖਾਸ ਤੌਰ 'ਤੇ ਜੇ ਮੈਂ ਗਾਇਣ ਦੀ ਗੱਲ ਕਰਾਂ ਤਾਂ ਉਸਦੇ ਲਈ ਗਾਇਣ ਦੀ ਜੋ ਸਿਖਲਾਈ ਹੈ ਉਹ ਕਿਸੇ ਗੁਰੂ ਤੋਂ ਹੀ ਲੈਣੀ ਚਾਹੀਦੀ ਹੈ ਅੱਜ ਕੱਲ੍ਹ ਔਨਲਾਈਨ ਦਾ ਜ਼ਮਾਨਾ ਹੈ ਬਹੁਤ ਸਾਰੇ ਇੱਦਾਂ ਦੇ ਸਾਡੇ ਕੋਲ ਔਨਲਾਈਨ ਪਲੈਟਫੋਮ ਹਨ ਜਿਨ੍ਹਾਂ ਤੋਂ ਅਸੀਂ ਕੋਈ ਵੀ ਅ ਵਿੱਦਿਆ ਹੈ ਉਹ ਲੈ ਸਕਦੇ ਹਾਂ ਪਰ ਸੰਗੀਤ ਵਰਗੀ ਇੱਕ ਵਿੱਦਿਆ ਐਸੀ ਵਿੱਦਿਆ ਹੈ ਕਿ ਜਿਸ ਦੇ ਵਿੱਚ ਸਾਨੂੰ ਗੁਰੂ ਦੇ ਸਾਹਮਣੇ ਬੈਠ ਕੇ ਹੀ ਵਿੱਦਿਆ ਲੈਣੀ ਪਏਗੀ ਅਤੇ ਇਸੇ ਦੇ ਚੱਲਦੇ ਗੁਰੂ ਜੋ ਹੈ ਉਹ ਸਾਨੂੰ ਬਰੀਕੀਆਂ ਦੱਸ ਸਕਦੇ ਹਨ ਅਤੇ ਜੋ ਸਾਡੀਆਂ ਗਲਤੀਆਂ ਹਨ ਉਹ ਸਾਨੂੰ ਸਾਹਮਣੇ ਬੈਠ ਕੇ ਸੁਧਾਰ ਸਕਦੇ ਹਨ ਤਾਂ ਮੈਂ ਸੰਗੀਤ ਦੀ ਗਾਇਨ ਦੀ ਵਿੱਦਿਆ ਜੋ ਹੈ ਪੰਡਿਤ ਜਵਾਹਰ ਲਾਲ ਸ਼ਰਮਾ ਜੀ ਤੋਂ ਲਈ ਮੈਂ ਤਕਰੀਬਨ ਦਸ ਸਾਲ ਉਹਨਾਂ ਤੋਂ ਸਿੱਖਿਆ ਅਤੇ ਬਿਲਕੁਲ ਜਿੱਦਾਂ ਮੈਂ ਗੱਲ ਕੀਤੀ ਗੁਰੂ ਚੇਲਾ ਪਰੰਪਰਾ ਆਹਮੋ ਸਾਹਮਣੇ ਬੈਠ ਕੇ ਉਹ ਸਿਖਾਇਆ ਕਰਦੇ ਸਨ ਅਤੇ ਬਹੁਤ ਹੀ ਬਰੀਕੀਆਂ ਦੇ ਨਾਲ ਉਹ ਵਿੱਦਿਆ ਜੋ ਹਨ ਉਹ ਦਿੰਦੇ ਸਨ ਅਤੇ ਬਹੁਤ ਹੀ ਬਰੀਕੀਆਂ ਦੇ ਨਾਲ ਉਹ ਆਪਣੇ ਚੇਲੇ ਨੂੰ ਅ ਦੇਖਦੇ ਸਨ ਕਿ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੈ ਤਾਂ ਉਹ ਉਸੇ ਸਮੇਂ ਹੀ ਉਹ ਸੁਧਾਰ ਦਿੰਦੇ ਸਨ ਤਾਂ ਜਿਸ ਦੇ ਨਾਲ ਇਹ ਵਿੱਦਿਆ ਜੋ ਹੈ ਇਹ ਬਹੁਤ ਅਸਾਨ ਲੱਗਦੀ ਸੀ